ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੰਤ ਬੋਲ ਰਿਹਾ ਜੀ ਮੈਂ ਤੁਹਾਡੇ ਨਾ ਢਾਬੇ ਦੇ ਪੰਜਾਬੀ ਢਾਬੇ ਦੇ ਪਹਿਲਾਂ ਵੀ ਔਰਡਰ ਕੀਤਾ ਸੀ ਸਿੰਪਲ ਥਾਲ਼ੀ ਦਾ ਚਾਰ ਰੋਟੀਆਂ ਵਿੱਚ ਦੋ ਤਰ੍ਹਾਂ ਦੀ ਦਾਲ ਸਬਜ਼ੀ ਉਹਦੇ ਵਿੱਚ ਨਾ ਆਪਾਂ ਨੇ ਇੱਕ ਚੀਜ਼ ਐਡ ਕਰਵਾਉਣੀ ਹੈ ਜਿਵੇਂ ਕੀ ਇੱਕ ਦੋ ਲੱਸੀਆਂ ਐਡ ਕਰ ਦਿਓ ਇੱਕ ਕੋਕ ਦੀ ਬੋਤਲ ਐਡ ਕਰਕੇ ਨਾ ਸਾਡੇ ਦੱਸੇ ਹੋਏ ਪਤੇ 'ਤੇ ਭੇਜ ਦਿਓ ਜਿਹੜਾ ਅਤੇ ਆਪਣਾ ਪੇਮੈਂਟ ਬਣੇਗੀ ਉਹ ਅਸੀਂ ਕੈਸ਼ ਔਨ ਡਿਲੀਵਰੀ ਪੇਮੈਂਟ ਕਰਾਂਗੇ